ਦੇਖਣ ਲਈ ਸਾਡੀਆਂ ਮਨਪਸੰਦ ਥਾਵਾਂ ਜਿਵੇਂ ਹਰ ਸ਼ਹਿਰ ਦੇ ਵਿੱਚ ਆਪਣੀ ਮਨਪਸੰਦ ਥਾਵਾਂ ਹੁੰਦੀਆਂ ਹਨ ਜਿਵੇਂ ਕਿ ਅਸੀਂ ਪਟਿਆਲਾ ਸ਼ਹਿਰ ਦੇ ਹਾਂ ਸਾਡੇ ਮਨਪਸੰਦ ਥਾਵਾਂ ਹਨ ਧਾਰਮਿਕ ਸਥਾਨ ਹਨ ਅਤੇ ਜਿਵੇਂ ਕਿ ਦੁਖਨਿਵਾਰਨ ਸਾਹਿਬ ਗੁਰਦੁਆਰਾ ਹੋ ਗਿਆ ਅਤੇ ਕਾਲੀ ਮਾਤਾ ਮੰਦਿਰ ਹੋ ਗਿਆ ਇਹ ਧਾਰਮਿਕ ਸਥਾਨ ਸਾਡੇ ਮਨਪਸੰਦ ਹਨ ਅਤੇ ਚਿੜੀਆ ਘਰ ਹੋ ਗਿਆ ਇਹ ਸਾਡੇ ਘੁੰਮਣ ਫਿਰਨ ਦੇ ਮਨਪਸੰਦ ਸਥਾਨ ਹਨ ਸ਼ੀਸ਼ ਮਹਿਲ ਪਟਿਆਲਾ ਸ਼ਹਿਰ ਦੇ ਵਿੱਚ ਸ਼ੀਸ਼ ਮਹਿਲ ਅਤੇ ਰਾਜੇ ਦਾ ਮਹਿਲ ਘੁੰਮਣ ਫਿਰਨ ਵਾਲੇ ਸਥਾਨ ਹਨ ਅਤੇ ਅਸੀਂ ਜਿਵੇਂ ਹਿੱਲ ਸਟੇਸ਼ਨ ਜਾਂਦੇ ਹਾਂ ਅਤੇ ਉੱਥੇ ਵੀ ਸਾਡੇ ਕੁਛ ਧਾਰਮਿਕ ਸਥਾਨ ਹਨ ਹਿਮਾਚਲ ਦੇ ਵਿੱਚ ਜਿਵੇਂ ਬਾਬਾ ਬਾਲਕ ਨਾਥ ਅਸੀਂ ਹਰ ਸਾਲ ਜਾਂਦੇ ਉਹ ਸਾਡੀ ਮਨ ਪਸੰਦ ਥਾਵਾਂ ਨੇ ਅਤੇ ਨੈਣਾਂ ਦੇਵੀ ਹਿਮਾਚਲ ਦੇ ਵਿੱਚ ਮਾਤਾ ਮਾਤਾ ਦਾ ਅਸਥਾਨ ਹੈ ਉੱਥੇ ਜਾਂਦੇ ਹਾਂ ਅਸੀਂ ਉਹ ਮਨਪਸੰਦ ਹੈ ਅਤੇ ਹੋਰ ਵੀ ਬਹੁਤ ਸਾਰੀਆਂ ਮਨਪਸੰਦ ਥਾਵਾਂ ਹੁੰਦੀਆਂ ਹਨ ਹਰ ਬੰਦੇ ਦੀ ਆਪਣੀ ਆਪਣੀ ਜਿਵੇਂ ਕੁਛ ਕਸ਼ਮੀਰ ਜਾਂਦੇ ਹਨ ਕਸ਼ਮੀਰ ਦੇ ਵਿੱਚ ਡਲ ਝੀਲ ਹੈ ਉਹ ਵੀ ਮਨਪਸੰਦ ਹੈ

ਜਿਵੇਂ ਕਿ ਪੰਜਾਬ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਹਰਿਮੰਦਰ ਸਾਹਿਬ ਹੈ ਅਤੇ ਹਰ ਸਥਾਨ ਜਿਹੜੇ ਜਿਹੜੇ ਜਾਂਦੇ ਹਾਂ ਆਪਾਂ ਜਿਹੜੇ ਆਪਾਂ ਨੂੰ ਪਸੰਦ ਆ ਉੱਥੇ ਘੁੰਮਣਾ ਪਸੰਦ ਕਰਦੇ ਹਾਂ ਅਤੇ ਹੋਰ ਵੀ ਬਹੁਤ ਸਥਾਨ ਹਨ ਜਿਹੜੇ ਬਹੁਤ ਮਨਪਸੰਦ ਅਲੱਗ ਅਲੱਗ ਲੋਕਾਂ ਦੇ ਅਲੱਗ ਅਲੱਗ ਮਨਪਸੰਦ ਸਥਾਨ ਹੁੰਦੇ ਹਨ ਜਿਵੇਂ ਸਾਡੇ ਮਨਪਸੰਦ ਸਥਾਨ ਹਨ ਉਹ ਮੈਂ ਦੱਸ ਹੀ ਦਿੱਤੇ ਅਤੇ ਇਸ ਤਰ੍ਹਾਂ ਹਿੱਲ ਸਟੇਸ਼ਨਾਂ ਦੇ ਵਿੱਚ ਜ਼ਿਆਦਾ ਲੋਕ ਜਾਣਾ ਪਸੰਦ ਕਰਦੇ ਹਨ ਜਿਵੇਂ ਕੁਫਰੀ ਜਾਂਦੇ ਹਨ ਅਤੇ ਉੱਥੇ ਜਾਂਦੇ ਹਨ ਆਪਣਾ ਸ਼ਿਮਲਾ ਜਾਂਦੇ ਹਨ ਸ਼ਿਮਲਾ ਕਸੋਲੀ ਇਸ ਤਰ੍ਹਾਂ ਹਰ ਬਹੁਤ ਸਾਰੇ ਸੈਲਾਨੀ ਜਾਂਦੇ ਹਨ ਘੁੰਮਣ ਜਾਂਦੇ ਹਨ ਉਹ ਆਪਣੇ ਮਨਪਸੰਦ ਸਥਾਨ 'ਤੇ ਜਾਂਦੇ ਹਨ